ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਨਾ ਐਕਚੁਲੀ ਤੁਹਾਡੇ ਤੋਂ ਇੱਕ ਔਡਰ ਕੀਤਾ ਸੀਗਾ ਥੋੜ੍ਹੇ ਟਾਇਮ ਪਹਿਲਾਂ ਨਾ ਦਸ ਕੁ ਮਿੰਟ ਪਹਿਲਾਂ ਔਡਰ ਲਿਖਵਾਇਆ ਸੀ ਅਤੇ ਸਾਡੇ ਏਰੀਏ 'ਚ ਨਾ ਟਰੈਫਿਕ ਜਾਮ ਬਹੁਤ ਰਹਿੰਦਾ ਸ਼ਾਮ ਟਾਈਮ ਇਸ ਲਈ ਤੁਸੀਂ ਕੋਸ਼ਿਸ਼ ਕਰਿਓ ਕਿ ਉਹਨੂੰ ਪ੍ਰੋਪਰ ਇੱਦਾਂ ਪੈਕ ਕਰਿਓ ਕਿ ਉਹ ਠੰਡਾ ਨਾ ਹੋਏ ਅਤੇ ਥੋੜ੍ਹਾ ਜਿਹਾ ਟਰੈਫਿਕ ਦਾ ਗੂਗਲ ਮੈਪ ਲਗਾ ਕੇ ਉਸ ਏ ਉੱਧਰੋਂ ਹੀ ਜਾਇਓ ਜਿੱਧਰ ਮਤਲਬ ਘੱਟ ਹੋਏ ਟਰੈਫਿਕ ਬਾਕੀ ਤੁਹਾਨੂੰ ਔਡਰ 'ਚ ਲਿਖਿਆ ਹੀ ਹੋਇਆ ਕਿ ਕੀ ਆਪਾਂ ਔਡਰ ਕੀਤਾ ਹੋਇਆ ਤਿੰਨ ਚਾਰ ਚੀਜ਼ਾਂ ਆ ਸਨੈਕਸ ਨੇ ਅਤੇ ਸਬਜ਼ੀ ਹੈ ਅਤੇ ਫੁਲਕੇ ਨੇ ਅਤੇ ਇੱਕ ਚਾਵਲ ਵੀ ਆ ਉਹਦੇ ਵਿੱਚ ਬਸ ਤੁਸੀਂ ਪ੍ਰੋਪਰ ਇਹ ਰਿਕੁੈਸਟ ਹੈ ਉਹਨੂੰ ਪ੍ਰੋਪਰ ਪੈਕ ਕਰਕੇ ਭੇਜਿਉ ਕਿਉਂਕਿ ਅਸੀਂ ਕਾਫੀ ਟਾਈਮ ਤੋਂ ਨਾ ਤੁਹਾਡੇ ਤੋਂ ਹੀ ਔਡਰ ਕਰਵਾਉਂਦੇ ਨੇ ਸਾਰੇ ਕਾਫੀ ਅੱਛਾ ਖਾਣਾ ਹੈ ਤੁਹਾਡਾ ਅਸੀਂ ਬਿਲਕੁਲ ਸੈਟਿਸਫਾਈ ਹਾਂ ਤੁਹਾਡੇ ਤੋਂ ਬਸ ਇਹ ਰਿਕੁਐਸਟ ਸੀਗੀ ਜਾਂ ਤਾਂ ਤੁਸੀਂ ਵਾਰ ਵਾਰ ਕੋਲ ਕਰਦੇ ਰਿਹੋ ਸਾਨੂੰ ਪੁੱਛਦੇ ਰਿਹੋ ਕਿਸ ਸਾਇਡ ਤੋਂ ਮਤਲਬ ਐਡਰੈਸ 'ਚ ਤੁਹਾਨੂੰ ਕੋਈ ਵੀ ਦਿੱਕਤ ਹੋਏ ਤੁਹਾਨੂੰ ਜਾਂ ਪਤਾ ਨਾ ਲੱਗੇ ਰਸਤਾ ਵੈਸੇ ਤੁਸੀਂ ਪੁਰਾਣੇ ਆਪਣੇ ਡਿਲੀਵਰੀ ਬੋਅਏ ਨੂੰ ਹੀ ਭੇਜਿਓ ਜੋ ਪਹਿਲਾਂ ਲੈ ਕੇ ਆਉਂਦਾ ਸਾਡੇ ਐਡਰਸ 'ਤੇ ਹੈ ਨਾ ਠੀਕ ਹੈ ਜੀ ਥੈਂਕ ਯੂ